ਮੇਰਾ ਨਾਮ ਸਰਦਾਰ ਅਮਨਪ੍ਰੀਤ ਸਿੰਘ ਹੈ ਜੀ ਮੈਂ ਸ਼੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਏ ਮੈਂ ਆਪਣੀ ਗਰੈਜੁਏਸ਼ਨ ਬੀ ਐੱਸ ਸੀ ਨੋਨ ਮੈਡੀਕਲ ਸਾਇੰਸ ਸਟੀਮ 'ਚ ਕੀਤੀ ਹੈ ਉਹਤੇ ਬਾਅਦ ਮੈਂ ਬੀ ਐੱਡ ਮ ਮੈਥੇਮੈਟਿਕਸ ਐਂਡ ਸਾਇੰਸ ਵਿੱਚ ਕੀਤੀ ਹੈਗੀ ਹੈ ਮੇਰਾ ਏਮ ਹੈਗਾ ਮੈਂ ਅੱਗੇ ਜਾ ਕੇ ਵਧੀਆ ਇੱਕ ਟੀਚਰ ਬਣਾ ਤਾਂ ਜੋ ਆਪਣੇ ਜਿੱਥ ਜਿਹੜਾ ਵੀ ਮੇਰਾ ਸਕੂਲ ਹੈ ਜਾਂ ਜਿੱਥੇ ਨੇ ਮੇਰੇ ਪਿੰਡ ਦੇ ਆ ਉਹਨਾਂ ਦੇ ਬੱਚਿਆਂ ਨੂੰ ਉੱਥੇ ਨੂੰ ਮੈਂ ਵਧੀਆ ਸਿਧ ਸੇਧ ਦੇ ਸਕਾਂ ਉਹਨਾਂ ਨੂੰ ਮੈਂ ਕਿਉਂਕਿ ਜਿਹੜੇ ਸਾਡੇ ਪਿੰਡਾਂ ਵਿੱਚ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਜਿਹੜੇ ਬੱਚਿਆਂ ਨੂੰ ਜਿਹੜੀ ਸੇਧ ਦੀ ਜਾਂ ਇੱਕ ਚੰਗੀ ਇੱਕ ਯੋਗ ਅਗਵਾਈ ਦੀ ਬੜੀ ਕਮੀ ਰਹਿੰਦੀ ਹੈਗੀ ਹੈ ਅਤੇ ਉਹਤੋਂ ਬਾਅਦ ਜੇ ਮੈਨੂੰ ਹੋਰ ਕੋਈ ਪਿੰਡ 'ਚ ਸੁਧਾਰ ਕਰਨ ਲਈ ਬੋਲਿਆ ਜਾਵੇ ਤਾਂ ਮੈਂ ਸਾਰੇ ਨਾਲੋਂ ਪਹਿਲਾਂ ਤਾਂ ਇੱਕ ਬੱਚਿਆਂ ਦੇ ਖੇਡਣ ਵਾਸਤੇ ਇੱਕ ਗਰਾਊਂਡ ਬਣਾਊਂਗਾ ਜੀ ਨੰਬਰ ਦੋ 'ਤੇ ਜਿਹੜੀ ਸਾਡੇ ਪਿੰਡਾਂ ਵਿੱਚ ਆਮ ਤੌਰ 'ਤੇ ਸਾਡੇ ਸ਼ਹਿਰ 'ਚ ਵੀ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦੀ ਹੈਗੀ ਉਹ ਹੈਗੀ ਏ ਨੰਬਰ ਦੋ ਨੰਬਰ ਦੋ 'ਤੇ ਲਾਇਬ੍ਰੇਰੀ ਕਿਉਂਕਿ ਲਾਇਬ੍ਰੇਰੀ ਦੀ ਸਾਡਾ ਇਲਾਕਾ ਜਿਹੜਾ ਹੈਗਾ ਇਹ ਐਜੂਕੇਸ਼ਨ ਸਿਸਟਮ ਦੇ ਐਜੂਕੇਸ਼ਨ ਦੇ ਅਕੌਰਡਿੰਗ ਕਾਫ਼ੀ ਪੱਛੜਿਆਂ ਵਾ ਹੈਗਾ ਏ ਅਤੇ ਉੱਥੇ ਉਹ ਆਮ ਤੌਰ 'ਤੇ ਜਿਹੜੀ ਲਾਇਬ੍ਰੇਰੀ ਦੀ ਕਮੀ ਦੇਖਣ ਨੂੰ ਮਿਲਦੀ ਹੈਗੀ ਏ ਅਤੇ ਉਹਤੋਂ ਬਾਅਦ ਮੇਰਾ ਏਮ ਹੈਗਾ ਏ ਅਤੇ ਚੰਗਾ ਅਤੇ ਵਧੀਆ ਇੱਕ ਯੋਗ ਟੀਚਰ ਬਣਾ